ਦੌੜਨ ਦੇ ਨਾਲ਼ ਮੈਂ ਬਹੁਤ ਹੀ ਹਲ਼ਕਾ ਮਹਿਸੂਸ ਕਰਦਾ ਹਾਂ ਇਸ ਨਾਲ਼ ਮੇਰਾ ਸਰੀਰ ਬਹੁਤ ਹੀ ਤੰਦਰੁਸਤ ਮਹਿਸੂਸ ਕਰਦਾ ਹੈ ਅਤੇ ਮੈਂ ਆਪਣੇ ਕੰਮ ਤੇ ਅਸਾਨੀ ਨਾਲ਼ ਧਿਆਨ ਦੇ ਸਕਦਾ ਹਾਂ